ਮੈਂ ਚਿੱਤਰ ਬਣਾਉਣ ਵਿੱਚ ਬਹੁਤ ਸਾਰੇ ਚੀਜ਼ਾਂ ਦੀ ਵਰਤੋਂ ਕਰਦੀ ਹਾਂ ਸਭ ਤੋਂ ਪਹਿਲਾਂ ਮੈਂ ਸ਼ੀਟ ਨੂੰ ਸਕੇਲ ਦੀ ਸਹਾਇਤਾ ਨਾਲ ਵੱਖ ਵੱਖ ਬਰਾਬਰ ਭਾਗਾਂ ਵਿੱਚ ਵੰਡ ਲੈਂਦੀ ਹਾਂ ਫਿਰ ਉਸ 'ਤੇ ਕੱਚੇ ਤੌਰ 'ਤੇ ਚਿੱਤਰ ਬਣਾਉਂਦੀ ਹਾਂ ਜਦੋਂ ਚਿੱਤਰ ਪੂਰੀ ਤਰ੍ਹਾਂ ਬਣ ਜਾਂਦਾ ਹੈ ਫਿਰ ਉਸਨੂੰ ਪੱਕਾ ਕਰਨ ਲਈ ਵੱਖ ਵੱਖ ਤਰ੍ਹਾਂ ਦੀਆਂ ਪੈਂਸਲਾਂ ਦੀ ਵਰਤੋਂ ਕਰਦੀ ਹਾਂ ਜਿਸ ਦੇ ਅ ਨਾਲ ਚਿੱਤਰ ਬਹੁਤ ਵਧੀਆ ਬਣਦਾ ਹੈ ਜਿਵੇਂ ਕਿ ਮੈਂ ਇੱਕ ਸਰੀਰ ਦਾ ਚਿੱਤਰ ਬਣਾਉਣ ਲਈ ਵੱਖ ਵੱਖ ਅੰਗਾਂ ਨੂੰ ਬਹੁਤ ਵਧੀਆ ਤਰ੍ਹਾਂ ਨਾਲ ਪ੍ਰਦਰਸ਼ਿਤ ਕਰਦੀ ਹਾਂ